ਹੈਲੋ ਹਾਂਜੀ ਮੈਂ ਮੰਜੂ ਬਜਾਜ ਬੋਲਦੀ ਪਈ ਹਾਂ ਮੇਰੀ ਸਿਮਰਨ ਵੀਰ ਜੀ ਨਾਲ ਗੱਲ ਹੋ ਰਹੀ ਹੈ ਹਾਂਜੀ ਮੈਂ ਟ੍ਰੈਫਿਕ ਪੁਲਿਸ ਔਫਿਸਰ ਬੋਲ ਰਹੀ ਹਾਂ ਅਤੇ ਤੁਸੀਂ ਖਾਲਸਾ ਕੋਲੇਜ ਦੇ ਕੋਲ ਆਪਣਾ ਜਿਹੜਾ ਹੈਗਾ ਸੀ ਟ੍ਰੈਫਿਕ ਰੂਲ ਜੰਪ ਕੀਤਾ ਹੈ ਟ੍ਰੈਫਿਕ ਕਰੋਸ ਜੰਪ ਕੀਤਾ ਹੈ ਅਤੇ ਉਹ ਮੈਂ ਤੁਹਾਡਾ ਬਾਈਕ ਨੰਬ ਓਹ ਐਕਟਿਵਾ ਨੰਬਰ ਵੀ ਨੋਟ ਕਰ ਲਿਆ ਆ ਨਹੀਂ ਨਹੀਂ ਤੁਸੀਂ ਓਹ ਕੀਤਾ ਵੈ ਤਾਂ ਦੇਖੋ ਕੈਮਰੇ ਲੱਗੇ ਹੋਏ ਆ ਜਗ੍ਹਾ ਜਗ੍ਹਾ ਔਰ ਇਸ ਕਰਕੇ ਕੈਮਰੇ 'ਚ ਤੁਹਾਡੇ ਸਾਰਾ ਜੋ ਆਇਆ ਆ ਨੰਬਰ ਐਕਟਿਵਾ ਦਾ ਅਤੇ ਤੁਸੀਂ ਇੱਕ ਵਾਰੀ ਔਫਿਸ ਆਓ ਅਤੇ ਤੁਹਾਨੂੰ ਜੋ ਵੀ ਫਾਈਨ ਬਣਦਾ ਉਹ ਮੈਂ ਲਗਾਉਣਾ ਪੈਣਾ ਮੈਨੂੰ ਅਤੇ ਉਹ ਮੈਂ ਕੋਈ ਟਿਪ ਭਰਨ ਵਾਸਤੇ ਨਹੀਂ ਕਰਨਾ ਪਰ ਤੁਹਾਨੂੰ ਆਉਣਾ ਪੈਣਾ ਔਫਿਸ ਠੀਕ ਹੈ ਓਕੇ ਓਕੇ